ਹਾਂ ਇਰੀਗੇਸ਼ਨ ਡਿਪਾਰਟਮੈਂਟ ਤੋਂ ਬੋਲਦੇ ਪਏ ਹੋ ਮੈਂ ਮੀਡੀਆ ਤੋਂ ਬੋਲ ਰਹੀ ਹਾਂ ਮੈਂ ਜ਼ਰਾ ਕੁਛ ਰਿਕੋਰਡ ਲਈ ਪੁੱਛਣਾ ਸੀਗਾ ਕਿ ਜਿਹੜੇ ਪਿਛਲੇ ਸਾਲ ਪੰਜਾਬ ਵਿੱਚ ਫਲੱਡਸ ਆਏ ਹੈ ਉਹਨਾਂ ਦਾ ਮਤਲਬ ਕਾਰਨ ਕਿਆ ਹੈ ਕਿਉਂਕਿ ਬਹੁਤ ਜ਼ਿਆਦਾ ਡਿਸਟ੍ਰਕਸ਼ਨ ਹੋ ਚੁੱਕੀ ਹੈ ਉਸ ਕਾਰਨ ਮੈਨੂੰ ਲਾ ਆਪਣਾ ਡਿਟੇਲਸ ਚਾਹੀਦੀਆਂ ਸੀਗੀਆਂ ਅਤੇ ਮਤਲਬ ਇੰਨਾ ਪਾਣੀ ਆਉਣਾ ਨਹੀਂ ਚਾਹੀਦਾ ਸੀ ਨਾ ਜਿਹੜੇ ਜਿੱਥੇ ਜਿੱਥੇ ਪਾਣੀ ਆਇਆ ਹੈ ਉੱਥੇ ਇੰਨੇ ਲੋਕ ਰਹਿ ਰਹੇ ਸੀਗੇ ਉਹਨਾਂ ਦਾ ਜਿਹੜਾ ਕੰਮ ਹੈ ਉਹਨਾਂ ਦੇ ਘਰ ਹੈ ਉਹਨਾਂ ਦੇ ਖੇਤ ਵਗੈਰਾ ਸਭ ਡੁੱਬ ਗਏ ਨੇ ਇੰਨਾ ਜਾਨਹਾਨੀ ਵੀ ਇੰਨੀ ਹੋਈ ਹੈ ਲੇਕਿਨ ਤੁਹਾਨੂੰ ਥੋੜ ਲੇਕਿਨ ਤੁਹਾਨੂੰ ਥੋੜ੍ਹਾ ਜਿਹਾ ਆਹ ਮੇਨਟੇਨੈਂਸ ਰੱਖਣੀ ਚਾਹੀਦੀ ਸੀ ਨਾ ਡੈਮਸ ਵਗੈਰਾ ਦੀ ਤਾਂ ਕਿ ਜਿਹੜਾ ਪਾਣੀ ਹੈ ਕਿਤੇ ਹੋਰ ਆਹ ਸਾਈਡ ਛੱਡ ਸਕਦੇ ਅਤੇ ਜਿਹੜਾ ਪਿੰਡ ਵਗੈਰਾ ਹੈ ਜਿਹੜੇ ਬਚ ਬਚ ਜਾਂਦੇ ਬਚੇ ਤਾਂ ਬਹੁਤ ਘੱਟ ਹੈ ਹਾਂ ਡੈਥਸ ਬਹੁਤ ਹੋਈਆ ਹੈ ਜਿਹੜੇ ਬਚੇ ਵੀ ਹੈ ਉਹਨਾਂ ਦੇ ਜਿਹੜੇ ਘਰ ਹੈ ਸਾਰੇ ਉੱਜੜ ਗਏ ਹੈ ਉਹਨਾਂ ਨੇ ਆਪਦਾ ਜਿਹੜਾ ਮਤਲਬ ਲਾਈਕ ਕੋਈ ਜਿਵੇਂ ਖਰੇ ਪਾਣੀ ਨਾਲ ਖਰਾਬ ਹੋਣ ਵਾਲਾ ਸਮਾਨ ਜਿਵੇਂ ਫਰਨੀਚਰ ਵਗੈਰਾ ਉਹਨਾਂ ਨੇ ਉੱਤੇ ਰੱਖ ਤਾਂ ਦਿੱਤੇ ਲਾਈਕ ਛੱਤ ਵਗੈਰਾ ਤਾਂ ਇੰਨਾ ਪਾਣੀ ਨਹੀਂ ਆਵੇਗਾ ਲੇਕਿਨ ਕੁਛ ਫ਼ਾਇਦਾ ਨਹੀਂ ਹੋਇਆ ਜਿਹੜਾ ਫਲੱਡ ਸੀਗੇ ਉਹ ਸਾਰੇ ਸਭ ਕੁਛ ਖਰਾਬ ਕਰ ਗਏ ਉਹ ਹੀ ਤਾਂ ਹੁਣ ਇਹਦੇ ਲਈ ਰਿਸਪੋਂਸੀਬਲ ਕੋਣ ਹੈ ਫਿਰ ਲਾਈਕ ਸਨ ਤੁਹਾਨੂੰ ਥੋੜ੍ਹੀ ਜਿਹੀ ਤੁਹਾਨੂੰ ਥੋੜ੍ਹੀ ਜਿਹੀ ਮੇਨਟੇਨੈਂਸ ਹੁਣ ਰੱਖਣੀ ਰੱਖਣੀ ਚਾਹੀਦੀ ਸੀਗੀ ਤਾਂ ਕਿ ਜਿਹੜਾ ਨੁਕਸਾਨ ਆ ਉਹ ਘੱਟ ਹੋ ਸਕਦਾ ਚਲੋ ਓਕੇ ਮੈਂ ਰਿਪੋਈਟ ਹੀ ਹਾਂਜੀ ਮੈਨੂੰ ਜ਼ਰਾ ਵੀ ਅਰਜ਼ ਆਹ ਰਿਪੋਰਟ ਹੀ ਲਾਈਕ ਸਬਮਿਟ ਕਰਵਾਉਣੀ ਸੀਗੀ ਇਸ ਲਈ ਮੈਨੂੰ ਡਿਟੇਲਸ ਚਾਹੀਦੀਆਂ ਸੀਗੀਆਂ ਓਕੇ ਬਾਏ